ਪੰਜਾਬ ਵਿੱਚ ਸਥਾਨਕ ਕਲਾ ਅਤੇ ਸ਼ਿਲਪਕਾਰੀ ਦੇ ਦ੍ਰਿਸ਼ ਨਾਲ ਜੁੜਨ ਦੇ ਬਹੁਤ ਹੀ ਜ਼ਿਆਦਾ ਮਤਲਬ ਅਲੱਗ ਅਲੱਗ ਤਰੀਕੇ ਹਨ ਜਿਵੇਂ ਕਿ ਅ ਸਾਡੇ ਪੰਜਾਬੀ ਜੁੱਤੀ ਜੋ ਕਿ ਸਾਡੇ ਪੰਜਾਬ ਦੀ ਬਹੁਤ ਹੀ ਮਸ਼ਹੂਰ ਹੈ ਕਿ ਕੁੜੀਆਂ ਨੂੰ ਪੰਜਾਬੀ ਜੁੱਤੀ ਪਾਉਣਾ ਤਾਂ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਉਹ ਸਭ ਤੋਂ ਪਹਿਲਾਂ ਕੀ ਦੇਖਦੇ ਹਨ ਪੰਜਾਬੀ ਜੁੱਤੀ ਕਿੱਦਾਂ ਦੀ ਬਣੀ ਹੋਈ ਹੈ ਮਜਬੂਤ ਤਾਂ ਹੈਗੀ ਆ ਮਤਲਬ ਕਿ ਐਵੇਂ ਨਹੀਂ ਕਿ ਇੱਕ ਦੋ ਵਾਰੀ ਪਾਉਣ ਦੇ ਨਾਲ ਟੁੱਟ ਜਾਵੇ ਅਤੇ ਉਹਦੇ ਉੱਪਰ ਕੀ ਅਲੱਗ ਅਲੱਗ ਤਰ੍ਹਾਂ ਦੇ ਇਹ ਕਲਰ ਕੀਤੇ ਜਾਂਦੇ ਹਨ ਮੋਤੀ ਵਗੈਰਾ ਅਹੁ ਲਗਾਏ ਜਾਂਦੇ ਹਨ ਅਤੇ ਹੋਰ ਵੀ ਬਹੁਤ ਸਾਰੇ ਸਿਤਾਰੇ ਵਗੈਰਾ ਲਗਾਏ ਜਾਂਦੇ ਜੋ ਕਿ ਜੁੱਤੀ ਨੂੰ ਇੱਕ ਸਿੰਪਲ ਜੁੱਤੀ ਨੂੰ ਬਹੁਤ ਹੀ ਵਧੀਆ ਜੁੱਤੀ ਬਣਾ ਦਿੱਤਾ ਜਾਂਦਾ ਹੈ ਅਤੇ ਕੁੜੀਆਂ ਨੂੰ ਇੱਕ ਤਾਂ ਪਰਾਂਦੇ ਪਾਉਣ ਦਾ ਬਹੁਤ ਹੀ ਸ਼ੌਕ ਹੁੰਦਾ ਹੈ ਸ਼ੀਸ਼ਿਆਂ ਵਾਲੇ ਪਰਾਂਦੇ ਅੱਜ ਕੱਲ੍ਹ ਤਾਂ ਬਹੁਤ ਹੀ ਤਰ੍ਹਾਂ ਦੇ ਪਰਾਂਦੇ ਬਣਨੇ ਸਟਾਰਟ ਹੋ ਗਏ ਹਨ ਜੋ ਕਿ ਕੁੜੀਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦੇ ਹਨ ਅਤੇ ਸਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਸ਼ਿਲਪਕਾਰੀ ਅਤੇ ਦ੍ਰਿਸ਼ ਵੀ ਬਹੁਤ ਸਾਰੇ ਹੁੰਦੇ ਹਨ ਜਿਵੇਂ ਕਿ ਕਿ ਜੇ ਤੁਹਾਨੂੰ ਡਰੋਇੰਗ ਦੇ ਵਿੱਚ ਸਾਡੀ ਬਹੁਤ ਹੀ ਵਧੀਆ ਹਾ ਕਲਾ ਹੈਗੀ ਹੈ ਅਤੇ ਆਪਾਂ ਕੀ ਕਰਦੇ ਹਾਂ ਕਿ ਗੁਰੂ ਪੀਰਾਂ ਦੀਆਂ ਫੋਟੋਆਂ ਅਤੇ ਚਿੱਤਰ ਆਦਿ ਬਣਾਉਂਦੇ ਹਾਂ ਅਤੇ ਉਹ ਮਤਲਬ ਕਿ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੇ ਹਨ ਅਤੇ ਹੋਰ ਵੀ ਇੱਦਾਂ ਦੇ ਬਹੁਤ ਚੀਜ਼ਾਂ ਜਿਵੇਂ ਕਿ ਸੂਟ ਸੂਟ 'ਤੇ ਕੀ ਕੀਤਾ ਜਾਂਦਾ ਕਢਾਈ ਵਗੈਰਾ ਕੀਤੀ ਜਾਂਦੀ ਹੈ ਜੋ ਕਿ ਅਤੇ ਅਲੱਗ ਅਲੱਗ ਤਰ੍ਹਾਂ ਦੀ ਕਢਾਈ ਕੀਤੀ ਜਾਂਦੀ ਹੈ ਕੁੜੀਆਂ ਨੂੰ ਜਿਵੇਂ ਕਿ ਸਿੱਪੀਆਂ ਵਗੈਰਾ ਦੀ ਅਤੇ ਅਲੱਗ ਸੂਟ ਹੁੰਦੇ ਹੈ ਜੋਰਜੱਟ ਦੇ ਅਲੱਗ ਸੂਟ ਹੁੰਦੇ ਹੈ ਬਹੁਤ ਹੀ ਤਰ੍ਹਾਂ ਦੇ ਸੂਟ ਹੁੰਦੇ ਹਨ ਫੁਲਕਾਰੀ ਦੀ ਚੁੰਨੀ ਜੋ ਕਿ ਬਹੁਤ ਹੀ ਪੰਜਾਬ ਦੀ ਮਸ਼ਹੂਰ ਔਰ ਚੁੰਨੀਆਂ ਵਿੱਚੋਂ ਇੱਕ ਚੁੰਨੀ ਹੈਗੀ ਆ ਉਹਦੇ 'ਤੇ ਅਲੱਗ ਹੀ ਤਰ੍ਹਾਂ ਦੀ ਕਢਾਈ ਕੀਤੀ ਜਾਂਦੀ ਹੈ ਵੀ ਬਹੁਤ ਹੀ ਜ਼ਿਆਦਾ ਭਾਰੀ ਹੁੰਦੀ ਹੈ ਅਤੇ ਬਹੁਤ ਮਤਲਬ ਕਿ ਉਹ ਲੈਂਦੇ ਸਾਰ ਹੀ ਇਹ ਦੂਰੋਂ ਹੀ ਸੋਹਣੀ ਲੱਗਣੀ ਸਟਾਰਟ ਹੋ ਜਾਂਦੀ ਹੈ ਇਹੀ ਸਾਰੇ ਸ਼ਿਲਪਕਾਰੀ ਦੇ ਦ੍ਰਿਸ਼ ਹਨ ਬਹੁਤ ਤਰ੍ਹਾਂ ਦੇ